ਪੰਜਾਬੀ ਭਾਸ਼ਾ ਭਾਰਤ ਦੇ ਪੰਜਾਬ ਹਰਿਆਣਾ ਦਿੱਲੀ ਦੀ ਸਰਕਾਰੀ ਭਾਸ਼ਾ ਹੈ ਪੰਜਾਬੀ ਭਾਸ਼ਾ ਇੰਗਲੈਂਡ ਕੈਨੇਡਾ ਅਮੈਰੀਕਾ ਵਿਚ ਵੀ ਬੋਲੀ ਜਾਂਦੀ ਹੈ ਪੰਜਾਬੀ ਸਰਕਾਰੀ ਭਾਸ਼ਾ ਹੋਣ ਕਰਕੇ ਵਪਾਰ ਵਿੱਚ ਵੀ ਵਰਤੀ ਜਾਂਦੀ ਹੈ ਪੰਜਾਬੀ ਭਾਸ਼ਾ ਪਾਕਿਸਤਾਨ ਵਿੱਚ ਵੀ ਬੋਲੀ ਜਾਂਦੀ ਹੈ ਵੈਸੇ ਤਾਂ ਸਾਡਾ ਭਾਰਤ ਦੋ ਹਿੱਸਿਆਂ 'ਚ ਵੰਡਿਆ ਸੀ ਹਿੰਦੁਸਤਾਨ ਅਤੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਵਿੱਚ ਵੀ ਇਸ ਲਈ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਪੰਜਾਬ ਵਿੱਚ ਜਿੰਨਾ ਵਪਾਰ ਹੁੰਦਾ ਹੈ ਜਿਵੇਂ ਕਿ ਮਕਾਨ ਦੀ ਉਹ ਵੀ ਲਿਖਤ ਪੜ੍ਹਤ ਸਾਰੀ ਪੰਜਾਬੀ ਵਿੱਚ ਹੀ ਹੁੰਦੀ ਹੈ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਸਦਾ ਸਰਟੀਫਿਕੇਟ ਵੀ ਪੰਜਾਬੀ ਵਿੱਚ ਹੀ ਭਰਿਆ ਜਾਂਦਾ ਹੈ ਪੰਜਾਬ ਦੀ ਬੋਲੀ ਪੰਜਾਬੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿੰਨੇ ਵੀ ਪੰਨੇ ਲਿਖੇ ਗਏ ਹਨ ਗੁਰਮੁਖੀ ਲਿਪੀ ਵਿੱਚ ਹੀ ਲਿਖੇ ਗਏ ਹਨ ਇਸ ਲਈ ਸਾਡੀ ਪੰਜਾਬੀ ਭਾਸ਼ਾ ਬਹੁਤ ਖ਼ਾਸ ਹੈ ਜੋ ਕਿ ਵਪਾਰਾਂ ਵਿੱਚ ਵੀ ਇਸ ਕਰਕੇ ਪੰਜਾਬੀ ਵਿੱਚ ਹੀ ਬੋਲੀ ਜਾਂਦੀ ਹੈ